ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿਹੜੇ ਕਿਹੜੇ ਹੈ ਜੀ ਦਿਲ ਦਲਜੀਤ ਦੋਸਾਂਝ ਗਿੱਪੀ ਗਰੇਵਾਲ ਸੋਨਮ ਬਾਜਵਾ ਸੋਨੂੰ ਸੂਦ ਗੁਲਸ਼ਨ ਗਰੋਵਰ ਹਾਂਜੀ ਇਹ ਇਹ ਇਹ ਤਾਂ ਫਿ ਹੋਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰਦੇ ਇਸ ਤੋਂ ਇਲਾਵਾ ਜਿੱਦਾਂ ਸੁਖਵਿੰਦਰ ਸਿੰਘ ਅਤੇ ਜੈਜੀ ਬੀ ਇਹਨਾਂ ਨੇ ਹੋਲੀਵੁੱਡ ਫਿਲਮਾਂ ਦੇ ਵਿੱਚ ਗਾਣੇ ਵੀ ਆਪਣੇ ਗਾਏ ਹੋਏ ਆ ਇਹਨਾ ਦੇ ਬਹੁਤ ਵਧੀਆ ਇਹ ਐਕਟਿੰਗ ਕਰਦੇ ਆ ਇਹਨਾਂ ਦੀ ਅਵਾਜ਼ ਵੀ ਬੜੀ ਵਧੀਆ ਜੇ ਅਤੇ ਇਹ ਇਹਨਾਂ ਦਾ ਪਿਛੋਕੜ ਜਿਹੜਾ ਹੈ ਪੰਜਾਬ ਤੋਂ ਆ ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਆਪਾ ਨੂੰ ਫਿਲਮਾਂ ਇਹਨਾਂ ਦੇ ਇਸ ਕਰਕੇ ਬਹੁਤ ਵਧੀਆ ਲੱਗਦੀਆਂ ਅਤੇ ਧਰਮਿੰਦਰ ਭਾਜੀ ਜਿਹੜੇ ਉਹ ਸਰੀਰਿਕ ਪੱਖੋਂ ਵੀ ਬੜੇ ਵਧੀਆ ਅਤੇ ਸਨੀ ਦਿਓਲ ਵੀ ਅਤੇ ਉਹਨਾਂ ਦੀ ਐਕਟਿੰਗ ਵੀ ਬੜੀ ਵਧੀਆ ਹੁੰਦੀ ਹੈ ਹਾਂਜੀ ਆਹ ਸਿੰਗਰ ਹੈ ਇਹਨਾਂ ਦੇ ਗਾਣੇ ਮੈਨੂੰ ਬੜੇ ਵਧੀਆ ਲੱਗਦੇ ਆ ਸੁਖਵਿੰਦਰ ਜੀ ਦੀ ਆਵਾਜ਼ ਬਹੁਤ ਹੀ ਵਧੀਆ ਅਤੇ ਇਹ ਬਹੁਤ ਹੀ ਜ਼ਿਆਦਾ ਹੈਗੇ ਆ ਪੋਪੂਲਰ ਹੈਗੇ ਆ ਇਹਨਾਂ ਨੂੰ ਸਾਰੇ ਵਲਡ ਵਿੱਚ ਸੁਣਿਆ ਜਾਂਦਾ ਹਾਂਜੀ ਹਾਂਜੀ ਤੁਸੀਂ ਸੰਤੁਸ਼ਟ ਹੋ ਮੇਰੀ ਜਾਣਕਾਰੀ ਤੋਂ ਕਿੱਦਾਂ ਲੱਗੀ ਠੀਕ ਹੈ ਠੀਕ ਹੈ ਜੀ ਓਕੇ